ਵੈਸੇ ਤਾਂ ਮੇਰੀ ਤਰਾ ਪਸੰਦੀਦਾ ਤੈਰਾਕੀ ਮੰਜਲਾਂ ਬਹੁਤ ਸਾਰੀਆਂ ਹੈਗੀਆਂ ਏ ਉਹਦੇ ਵਿੱਚੋਂ ਜਿੱਦਾਂ ਹੁਣ ਮੈਂ ਇਟਲੀ 'ਚ ਰਿਹਾ ਇਟਲੀ 'ਚ ਵੀ ਮੇਰੀਆਂ ਪਸੰਦੀਦਾ ਤੈਰਾਕੀ ਮੰਜਲਾਂ ਬਹੁਤ ਸਾਰੀਆਂ ਉਹਨਾਂ ਵਿੱਚੋਂ ਜਿਹੜੀ ਸਾਰਿਆਂ 'ਚੋਂ ਫੇਵਰੇਟ ਹੈਗੀ ਹੈ ਉਹ ਹੈਗੀ ਹੈ ਮੇਰੇ ਸਤਲੁਜ ਦਾ ਇੱਥੇ ਦਾ ਪੰਜਾਬ ਦਾ ਜਿੱਦਾਂ ਨਵਾਂਸ਼ਹਿਰ ਜਿਹੜਾ ਵੱਗਦਾ ਸਤਲੁਜ ਦਰਿਆ ਉਹ ਮੇਰੀ ਪਸੰਦੀਦਾ ਮੰਜਲ ਹੈਗੀ ਹੈ ਇਹਦੇ ਵਿੱਚ ਹੈਗਾ ਏ ਇੱਕ ਤਾਂ ਜਿੱਦਾਂ ਹੁਣ ਆਪਾਂ ਪਹਿਲਾਂ ਬਚਪਨ ਦੀਆਂ ਇਹਦੇ ਵਿੱਚ ਤੈਰ ਕੇ ਮੇਰੀਆਂ ਬਚਪਨ ਦੀਆਂ ਤਾਜ਼ਾ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹੈਗੀਆਂ ਏ ਇਹਦੇ ਨਾਲ਼ ਕਿਆ ਤਾ ਜਿੱਦਾਂ ਹੁਣ ਮੈਂ ਜਦੋਂ ਇੱਥੇ ਮੈਂ ਰਹਿੰਦਾ ਸੀਗਾ ਪੁਰਾਣੇ ਸਮਿਆਂ ਮਾ ਜਦੋਂ ਮੈਂ ਆਪਾਂ ਦੋਸਤ ਸੀਗੇ ਇੱਥੇ ਤੈਰਦੇ ਹੁੰਦੇ ਸੀਗੇ ਇੱਥੇ ਹੋਰ ਵੀ ਗੱਪਾਂ ਮਾਰਦੇ ਸੀਗੇ ਘੁੰਮਦੇ ਫਿਰਦੇ ਹੁੰਦੇ ਸੀਗੇ ਅਤੇ ਇਹਦੇ ਨਾਲ਼ ਇੱਥੇ ਮੇਰੇ ਤੈਰ ਕੇ ਜੋ ਜ ਯਾਰਾਂ ਦੋਸਤਾਂ ਦੀਆਂ ਯਾਦਾਂ ਵੀ ਤਾਜ਼ੀਆਂ ਹੋਈਆਂ ਜਦੋਂ ਵੀ ਮੈਨੂੰ ਆਪਣੇ ਯਾਰਾਂ ਦੋਸਤਾਂ ਦੀ ਯਾਦ ਆਉਂਦੀ ਹੈ ਤਦੋਂ ਮੈਂ ਆਪਣੇ ਦਰਿਆ ਦੇ ਕੰਢੇ ਆ ਕੇ ਇੱਥੇ ਬੈਠ ਜਾਂਦਾ ਐਂ ਜਾਂ ਫਿਰ ਤੈਰਾਕੀ ਲਾ ਲੈਂਦਾ ਪਰ ਵੈਸੇ ਹੁਣ ਤਾਂ ਮੈਂ ਉਮਰ ਵੀ ਮੇਰੀ ਕਾਫੀ ਹੋ ਗਈ ਇਹਦੇ ਕਰਕੇ ਹੁਣ ਮੈਂ ਤੈਰਨਾ ਵੀ ਜ਼ਿਆਦਾ ਪਸੰਦ ਨਹੀਂ ਕਰਦਾ ਹੈਗਾ ਏ ਅਤੇ ਮੇਰੀ ਪਸੰਦੀਦਾ ਇਹੀ ਹੈ ਸਤਲੁਜ ਦਰਿਆ ਵਿੱਚ ਮੈਨੂੰ ਤੈਰ ਕੇ ਆਪਣੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਨੀਆਂ ਬੜੀਆਂ ਵਧੀਆ ਲੱਗਦੀਆਂ ਹੈਗੀਆਂ ਏ